ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਤੁਸੀਂ ਸਵੀਗੀ ਤੋਂ ਬੋਲ ਰਹੇ ਹੋ ਠੀਕ ਧੰਨਵਾਦ ਮੇ ਮੈਂ ਤੁਹਾਡੇ ਕੋਲੋਂ ਇੱਕ ਔਡਰ ਮੰਗਵਾਇਆ ਸੀ ਬਰਗਰ ਦਾ ਹਾਂ ਪੀਜ਼ਾ ਹੱਟ ਤੋਂ ਹਾਂਜੀ ਉਂਝ ਤਾਂ ਮੈਂ ਆਪਣਾ ਐਡਰੈਸ ਮੈਨਸ਼ਨ ਕੀਤਾ ਹੋਇਆ ਆਪਣੀ ਆਈ ਡੀ 'ਚ ਅਤੇ ਕਾਲ ਮੈਂ ਇਸ ਲਈ ਕੀਤਾ ਸੀ ਕਿ ਤੁਹਾਨੂੰ ਮੈਂ ਥੋੜ੍ਹਾ ਆਪਣਾ ਐਡਰੈਸ ਦੱਸ ਦੇਵਾਂ ਕਿ ਕਿਤੇ ਕਰਕੇ ਆਉਣਾ ਏ ਹਾਂਜੀ ਤੁਸੀਂ ਨਾ ਬਸੰਤ ਐਵਨਿਊ ਆ ਜਿਓ ਬਸੰਤ ਐਵਨਿਊ ਆ ਕੇ ਜਿਹੜੀ ਗਲੀ ਨੰਬਰ ਚਾਰ ਹੈ ਉਹਦੇ ਅੰਦਰ ਆ ਜਿਓ ਗਲੀ ਨੰਬਰ ਚਾਰ ਅੰਦਰ ਇੱਕ ਗੁਰਦੁਆਰਾ ਹੋਏਗਾ ਮਾਤਾ ਗੁਜਰੀ ਕੌਰ ਦਾ ਹਾਂ ਹਾਂ ਉਹੀ ਗੁਰਦੁਆਰਾ ਛ ਹਾਂਜੀ ਉਹ ਗੁਰਦੁਆਰੇ ਕੋਲ ਆ ਕੇ ਤੁਸੀਂ ਕਿਸੇ ਨੂੰ ਵੀ ਪੁੱਛ ਲਉ ਕਿ ਲੱਕੀ ਦਾ ਘਰ ਕਿੱਥੇ ਕਰਕੇ ਹੈਗਾ ਏ ਆ ਹਾਂ ਜੇਕਰ ਨਹੀਂ ਪਤਾ ਲੱਗੇਗਾ ਤੁਸੀਂ ਮੈਨੂੰ ਫਿਰ ਤੋਂ ਕੋਲ ਕਰ ਲਿਓ ਜਾਂ ਤਾਂ ਮੈਂ ਕੋਲ ਕਰ ਦਿਓ ਮੈਂ ਉੱਧਰ ਹੀ ਆ ਕੇ ਔਡਰ ਰਸੀਵ ਕਰ ਲੂੰਗਾ ਹਾਂਜੀ ਲੈਂਡਮਾਰਕ ਓਹੀ ਗੁਰਦੁਆਰਾ ਹੀ ਹੈਗਾ ਜੇ ਹਾਂ ਗੁਰਦੁਆਰੇ ਤੋਂ ਤੀਜਾ ਘਰ ਉਂਝ ਮੇਰਾ ਹੈਗਾ ਜੇ ਤੁਸੀਂ ਆ ਸਕਦੇ ਹੋਏ ਤਾਂ ਆ ਜਿਓ ਧੰਨਵਾਦ ਓਕੇ